ਜਿਵੇਂ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜਿਆਦਾ ਸ਼ੌਂਕ ਹੈ ਤੇ ਇਸ ਦੇ ਨਾਲ਼ ਨਾਲ਼ ਮੈਨੂੰ ਕਿਤਾਬਾਂ ਦੀ ਕਲੈਕਸ਼ਨ ਕਰਨਾ ਕਲੈਕਸ਼ਨ ਕਰਕੇ ਰੱਖਣਾ ਵੀ ਬਹੁਤ ਜਿਆਦਾ ਪਸੰਦ ਹੈ ਅਤੇ ਇਸ ਦੇ ਸੰਬੰਧ ਵਿੱਚ ਜਿੱਥੋਂ ਵੀ ਮੈਨੂੰ ਕਿਤੇ ਠੀਕ ਲੱਗਦਾ ਹੈ ਮੈਨੂੰ ਕੋਈ ਆਪਸ਼ਨ ਮਿਲਦੀ ਹੈ ਮੈਂ ਬੁਕਸ ਖਰੀਦ ਲੈਦੀ ਆਂ ਜਿਵੇਂ ਕਿ ਮੈਂ ਜਿਆਦਾਤਰ ਬੁਕਸ ਆਪਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ਤੋਂ ਪੜ੍ਹਨ ਵਾਸਤੇ ਲੈ ਲੈਂਦੀ ਹਾਂ ਜਾਂ ਫਿਰ ਮੈਂ ਕਈ ਵਾਰ ਔਨਲਾਈਨ ਵੀ ਬਹੁਤ ਸਾਰੀਆਂ ਕਿਤਾਬਾਂ ਮੰਗਵਾਈਆਂ ਹਨ ਇਸ ਤੋਂ ਇਲਾਵਾ ਮੈਂ ਈ ਬੁੱਕਸ ਵੀ ਪੜ੍ਹਦੀ ਰਹਿੰਦੀ ਹਾਂ ਅਤੇ ਯੂਨੀਵਰਸਿਟੀ ਦੇ ਵਿੱਚ ਬੁੱਕ ਫੇਅਰ ਲੱਗਦਾ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੇ ਮਤਲਬ ਕਿ ਜੋ ਵਧੀਆ ਲਿਖਾਰੀ ਹਨ ਵਧੀਆ ਲੇਖਕ ਹਨ ਉਹਨਾਂ ਦੀਆਂ ਕਿਤਾਬਾਂ ਹਨ ਉਹ ਮੈਂ ਉਥੋਂ ਬੁੱਕ ਫਿਰ ਤੋਂ ਲੈ ਲੈਂਦੀ ਹਾਂ ਇਸ ਤੋਂ ਇਲਾਵਾ ਹੋਰ ਕਾਲਜਾਂ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਜਿੱਥੇ ਵੀ ਕਿਤੇ ਵੀ ਬੁੱਕ ਫੇਅਰ ਲੱਗਦਾ ਹੈ ਉਥੋਂ ਅਸੀਂ ਜਾ ਕੇ ਦੇਖਦੇ ਹਨ ਅਤੇ ਬੁੱਕਸ ਖਰੀਦ ਲੈਂਦੇ ਹਨ